ਜੀ ਅਸੀਂ ਜਾਣਾ ਜੀ ਇੱਥੋਂ ਦੀ ਦੇਹਰਾਦੂਨ ਦੱਸੋ ਸਾਨੂੰ ਕੀ ਹਿਸਾਬ ਕਿਤਾਬ ਹੈ ਆਉਣ ਜਾਣ ਕਿਰਾਇਆ ਕੀ ਹੈ ਕੀ ਕੀ ਤੁਹਾਡੀ ਫੈਸਿਲੀਟੀ ਹੈ ਕੀ ਕੀ ਤੁਸੀਂ ਸਾਨੂੰ ਸੁਵਿਧਾ ਦੇਵੋਗੇ ਠੀਕ ਹੈ ਅਸੀਂ ਪੰਜ ਪਰਿਵਾਰ ਦੇ ਜੀਅ ਹੈ ਜਿਨ੍ਹਾਂ ਨਾਲ ਅਸੀਂ ਇਕੱਠਿਆ ਨੇ ਜਾਣਾ ਹੈ ਅਤੇ ਸਾਨੂੰ ਦੱਸੋ ਕਿੰਨੇ ਕਿਲੋਮੀਟਰ ਦੇ ਹਿਸਾਬ ਨਾਲ ਤੁਸੀਂ ਸਾਨੂੰ ਇਹ ਸਾਰਾ ਕੁਛ ਦੱਸੋਗੇ ਕਿੰਨੀ ਕਿੰਨੀ ਸਾਨੂੰ ਸੁਵਿਧਾ ਦੇਵੋਗੇ ਜੋ ਵੀ ਆਉਣ ਜਾਣ ਦਾ ਕਿਰਾਇਆ ਹੈ ਉਹ ਸਾਡੇ ਬਾਰੇ ਸਾਨੂੰ ਉਹਦੇ ਬਾਰੇ ਜਾਣਕਾਰੀ ਦਿਉ